ਹੈਲੋ ਸਤਿ ਸ਼੍ਰੀ ਅਕਾਲ ਜੀ ਕੋਣ ਬੋਲਦੇ ਆ ਅੱਛਾ ਅੱਛਾ ਰੋਪੜ ਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਹੋਰ ਕਿਆ ਹਾਲ ਚਾਲ ਹੈ ਭੈਣ ਜੀ ਬਸ ਵਧੀਆ ਅਸੀਂ ਵੀ ਬੱਚੇ ਲੱਗੇ ਵੇ ਆਪਣੀਆਂ ਪੜ੍ਹਾਈਆਂ ਕਰਨ ਤੁਸੀਂ ਦੱਸੋ ਤੁਹਾਡੇ ਬੱਚਿਆਂ ਦਾ ਕਿਆ ਬਣਿਆ ਕਹਿੰਦੇ ਤੇ ਬਾਹਰ ਬੁਹਰ ਜਾਣਾ ਉਨ੍ਹਾਂ ਨੂੰ ਲੈ ਤੁਸੀਂ ਦੱਸਿਆ ਹੀ ਨਹੀਂ ਹੈਗਾ ਹੈਂ ਲੈ ਤੇ ਦੱਸਣਾ ਤਾਂ ਚਾਹੀਦਾ ਸੀ ਮਿਲ ਜਾਂਦੇ ਆ ਕੇ ਬੱਚਿਆਂ ਨੂੰ ਹਾਂ ਅੱਛਾ ਅੱਛਾ ਲੱਗ ਜਾਂਦਾ ਸਾਡੇ ਵੀ ਪੜੋਸੀਆਂ ਦੇ ਗਏ ਆ ਉਨ੍ਹਾਂ ਨੇ ਵੀ ਨਹੀਂ ਆਹੀ ਪਤਾ ਵੀ ਨਹੀਂ ਲੱਗਿਆ ਕਦ ਚਲੇ ਗਏ ਕਦ ਜਹਾਜ਼ ਚੜ੍ਹਾ ਤੇ ਚੱਲ ਉਹ ਤਾਂ ਠੀਕ ਆ ਪਰ ਜੇ ਪਤਾ ਹੋਊ ਬੰਦਾ ਮਿਲ ਗਿਲ ਜਾਂਦਾ ਇੰਨੀ ਆਪਣੇ ਆਪ

ਉਹ ਤਾਂ ਆਪਣੀ ਭੂਆ ਕੋਲ ਵੀ ਨਹੀਂ ਆਏ ਉਹ ਮੇਰੇ ਨਾਲੇ ਤਾਂ ਰਹਿੰਦੀ ਆ ਉਹ ਹਾਂ ਅੱਛਾ ਅੱਛਾ ਉਹਨੇ ਦੱਸਿਆ ਵੀ ਨਹੀਂ ਕਦੇ ਦੱਸਿਆ ਉਹ ਚਲੇ ਗਏ ਬਾਹਰ ਨੂੰ ਹਾਂ ਨਹੀਂ ਠੀਕ ਠਾਕ ਹੈ ਹੁਣ ਬਾਹਰ ਬਾਹਰ ਠੀਕ ਆ ਕੰਮ ਕੁੰਮ ਮਿਲ ਗਿਆ ਕਹਿੰਦੇ ਕੰਮ ਨਹੀਂ ਮਿਲਦਾ

ਅੱਛਾ ਅੱਛਾ ਅੱਛਾ ਹਾਂ ਹਾਂ ਅੱਛਾ ਸਾਡੇ ਤਾਂ ਕਹਿੰਦੇ ਕੰਮ ਨਹੀਂ ਹੈਗਾ ਸਾਡਾ ਤਾਂ ਆਪ ਜਾਣਾ ਤਾ ਮੁੰਡੇ ਨੇ ਹਾਂ ਹਾਂ ਚੱਲ ਫਿਰ ਮਾਰਿਓ ਚੱਕਰ ਕਿਤੇ ਆਊਂਗੇ ਨਹੀਂ ਤਾਂ ਫਿਰ ਬੜੇ ਦਿਨ ਹੋ ਗਏ ਮਿਲੇ ਨੂੰ ਹਾਂ ਚੱਲ ਠੀਕ ਹੈ ਭੈਣ ਜੀ ਠੀਕ ਹੈ ਚੰਗਾ ਸਤਿ ਸ਼੍ਰੀ ਅਕਾਲ ਓਕੇ ਬਾਏ